ਪਹਾੜ ਇਹ ਸ਼ਬਦ ਸੁਣਦੇ ਹੀ ਕਈ ਲੋਕਾਂ ਦੇ ਮਨ ਵਿੱਚ ਉਤਸ਼ਾਹ ਪੈਦਾ ਹੋ ਜਾਂਦਾ ਹੈ ਪਹਾੜ ਕੁਦਰਤ ਵੱਲੋਂ ਬਣਾਈ ਹੋਈ ਬਹੁਤ ਹੀ ਅਣਮੁੱਲੀ ਚੀਜ਼ ਆਪਾਂ ਕਹਿ ਸਕਦੇ ਹਾਂ ਪਹਾੜਾਂ ਨੂੰ ਚੜ੍ਹਨਾ ਜਾਂ ਚੜ੍ਹਾਈ ਕਰਨਾ ਹੀ ਟਰੈਕਿੰਗ ਮੰਨਿਆ ਗਿਆ ਹੈ ਟਰੈਕਿੰਗ ਅੱਜ ਕੱਲ੍ਹ ਦੇ ਟਾਈਮ ਵਿੱਚ ਬਹੁਤ ਹੀ ਪ੍ਰਚਲਿਤ ਹੋ ਗਈ ਹੈ ਆਪਣੇ ਦੇਸ਼ ਵਿੱਚ ਬਹੁਤ ਸੇ ਪਾ ਬਹੁਤ ਸਾਰੇ ਪਹਾੜ ਹਨ ਜਿੱਥੇ ਕਿ ਲੋਕ ਟਰੈਕਿੰਗ ਕਰਨ ਜਾਂਦੇ ਹਨ ਅੱਜ ਕੱਲ੍ਹ ਤਾਂ ਸਰਕਾਰਾਂ ਵੱਲੋਂ ਟਰੈਕਿੰਗ ਨੂੰ ਬਹੁਤ ਹੀ ਉਤਸ਼ਾਹ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਤਾਂ ਜੋ ਉਸ ਇਲਾਕੇ ਵਿੱਚ ਟੂਰਿਜ਼ਮ ਨੂੰ ਬਹੁਤ ਜ਼ਿਆਦਾ ਬੜਾਵਾ ਦਿੱਤਾ ਜਾ ਸਕੇ ਟਰੈਕਿੰਗ ਕਰਨਾ ਵੈਸੇ ਇੰਨਾ ਮੁਸ਼ਕਲ ਵੀ ਨਹੀਂ ਹੈ ਪਰ ਇਹ ਇੱਕ ਆਸਾਨ ਚੀਜ਼ ਵੀ ਨਹੀਂ ਹੈ ਟਰੈਕਿੰਗ ਕਰਦੇ ਸਮੇਂ ਬਹੁਤ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਕ ਮਜ਼ਬੂਤ ਟਰੈਕਰ ਜਾਂ ਕਹੀਏ ਕਿ ਇੱਕ ਮਜ਼ਬੂਤ ਆਦਮੀ ਹੀ ਟਰੈਕਿੰਗ ਨੂੰ ਆਸਾਨੀ ਨਾਲ ਪੂਰਾ ਕਰ ਸਕਦਾ ਹੈ ਟ੍ਰੈਕਿੰਗ ਕਰਨ ਨਾਲ ਇੱਕ ਤਾਂ ਇਨਸਾਨ ਇਨਸਾਨ ਦੇ ਇਨਸਾਨ ਦਾ ਮੂਡ ਫਰੈਸ਼ ਹੋ ਜਾਂਦਾ ਹੈ ਅਤੇ ਵਹ ਆਪਣੇ ਜਿਹੜੇ ਰੋਜ਼ ਦੇ ਰੋਜ਼ ਦੀ ਜਿਹੜੀ ਉਹਨੂੰ ਟੈਨਸ਼ਨ ਹੈ ਉਹ ਹੈ ਉਸ ਨੂੰ ਦੂਰ ਕਰ ਸਕਦਾ ਹੈ ਟਰੈਕਿੰਗ ਟਰੈਕਿੰਗ ਕਰਨ ਕਰਨ ਵੇਲੇ ਬਹੁਤ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਚੁਣੌਤੀਆਂ ਕਿਸੇ ਤਰ੍ਹਾਂ ਵੀ ਹੋ ਸਕਦੀਆਂ ਹਨ ਜਿਵੇਂ ਕਿ ਖਰਾਬ ਮੌਸਮ ਜਾਂ ਤੁਹਾਡਾ ਜਾਂ ਤੁਸੀਂ ਬਿਮਾਰ ਹੋ ਜਾਣਾ ਜਾਂ ਡੀਹਾਈਡਰੇਸ਼ਨ ਡੀਹਾਈਡਰੇਸ਼ਨ ਹੋ ਜਾਣਾ ਟਰੈਕਿੰਗ ਕਰਨ ਟਰੈਕਿੰਗ ਕਰਨ ਵਾਲੇ ਵਿਅਕਤੀ ਵਿੱਚ ਇੱਕ ਅਲੱਗ ਹੀ ਉਤਸ਼ਾਹ ਦੇਖਿਆ ਜਾਂਦਾ ਹੈ ਟਰੈਕਿੰਗ ਇੱਕ ਬਹੁਤ ਹੀ ਵਧੀਆ ਚੀਜ਼ ਮੰਨੀ ਗਈ ਹੈ ਅਤੇ ਇਸਦਾ ਅੱਜ ਕੱਲ੍ਹ ਸਰਕਾਰਾਂ ਵੱਲੋਂ ਵੀ ਬਹੁਤ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਉਸ ਇਲਾਕੇ ਵਿੱਚ ਟੂਰਿਜ਼ਮ ਨੂੰ ਬਹੁਤ ਬੜਾਵਾ ਮਿਲਦਾ ਹੈ ਹਿਮਾਚਲ ਵਿੱਚ ਕਈ ਟਰੈਕ ਹਨ ਜਿਵੇਂ ਕਿ ਧਰਮਸ਼ਾਲਾ ਕੋਲ ਵੀ ਇੱਕ ਟਰੈਕ ਹੈ ਅਤੇ ਉਸ ਟਰੈ ਉਸ ਟਰੈਕ ਉਸ ਟਰੈਕ ਵਿੱਚ ਵੀ ਅੱਜ ਕੱਲ੍ਹ ਬਹੁਤ ਰਸ਼ ਰਹਿਣ ਲੱਗ ਗਿਆ ਹੈ ਧੰਨਵਾਦ